ਹਾਂਜੀ ਮੈਂ ਕੱਪੜੇ ਵੋਸ਼ਿੰਗ ਮਸ਼ੀਨ ਵਿੱਚ ਧੋਂਦਾ ਹਾਂ ਅਤੇ ਜਦੋਂ ਧੁੱਪ ਹੁੰਦੀ ਹੈ ਤਾਂ ਕੱਪੜੇ ਬਾਹਰ ਸੁਕਾ ਲਈਦੇ ਹੈ ਨਹੀਂ ਤਾਂ ਫਿਰ ਤੋਂ ਅਪ ਕਮਰੇ ਦੇ ਅੰਦਰ ਪੱਖਾ ਲਗਾ ਕੇ ਉੱਥੇ ਸਕਾ ਲੈਂਦੇ ਹਾਂ